ਮੈਨੂੰ ਬਾਗ਼ਬਾਨੀ ਕਰਨ ਦਾ ਬਹੁਤ ਸ਼ੌਕ ਹੈ ਮੈਂ ਪਹਿਲਾਂ ਤੋਂ ਹੀ ਬ ਕਾਫ਼ੀ ਸ਼ੌਕੀਨ ਹਾਂ ਬਾਗ਼ਬਾਨੀ ਦੀ ਇਸ ਲਈ ਮੈਂ ਥੋੜ੍ਹੇ ਜਿਹੇ ਗਮਲੇ ਲਏ ਗਮਲਿਆਂ ਵਿੱਚ ਮਿੱਟੀ ਪਾ ਕੇ ਉਹਦੇ ਵਿੱਚ ਥੋੜ੍ਹੀ ਜਿਹੀ ਦੇਸੀ ਰੂੜੀ ਰਲਾਈ ਰੂੜੀ ਰਲਾ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਜਿਸ ਤਰ੍ਹਾਂ ਸਜਾਵਟ ਵਾਲੇ ਫੁੱਲ ਉਹ ਉਗਾ ਤੇ ਪਹਿਲਾਂ ਉਹਨਾਂ ਨੂੰ ਮ ਲਿਆ ਫਿਰ ਉਗਾ ਤਾ ਉਗਾ ਕੇ ਥੋੜ੍ਹਾ ਜਿਹਾ ਪਾਣੀ ਪਾ ਤਾ ਉਸ ਤੋਂ ਬਾਅਦ ਮੈਂ ਥੋੜ੍ਹੀ ਜਿਹੀ ਜਗ੍ਹਾ ਬਣਾ ਕੇ ਸਾਫ਼ ਜਿਹੀ ਜਗ੍ਹਾ ਕਰਕੇ ਉਹਦੇ ਵਿੱਚ ਗੁਡਾਈ ਕੀਤੀ ਗੁਡਾਈ ਕਰਕੇ ਉਸਦੇ ਵਿੱਚ ਥੋੜ੍ਹੀ ਜਿਹੀ ਦੇਸੀ ਰੂੜੀ ਰਲਾਈ ਦੇਸੀ ਰੂੜੀ ਰਲਾ ਕੇ ਉਹਨੂੰ ਥੋੜ੍ਹਾ ਜਿਹਾ ਵੱਤਰ ਲਈ ਰੱਖ ਦਿੱਤਾ ਜਦ ਵੱਤਰ ਆ ਗਿਆ ਦੂਸਰੇ ਦਿਨ ਰਾਤ ਨੂੰ ਪਾਣੀ ਛਿੜਕਾਅ ਕੇ ਵੱਤਰ ਆ ਗਿਆ ਸਵੇਰੇ ਮੈਂ ਉਹਦੇ ਵਿੱਚ ਥੋੜ੍ਹਾ ਜਿਹਾ ਧਨੀਆ ਅਤੇ ਮੇਥੀ ਦੀ ਤਿੰਨ ਕਿਆਰੀਆਂ ਬਣਾ ਕੇ ਉਹਦੇ ਵਿੱਚ ਧਨੀਆ ਅਤੇ ਮੇਥੀ ਲਗਾਇਆ ਥੋੜ੍ਹੀ ਜਿਹੜੀਆਂ ਵੱਟਾਂ ਬਣਾਈਆਂ ਉਹਦੇ 'ਤੇ ਮੂਲੀਆਂ ਲਗਾਈਆਂ ਧਨੀਆ ਅਤੇ ਮੇਥੀ ਦਾ ਬੀ ਐਨਾ ਵਧੀਆ ਸੀ ਕਿ ਚੌਥੇ ਪੰਜਵੇਂ ਦਿਨ ਧਨੀਏ ਚੌਥੇ ਪੰਜਵੇਂ ਦਿਨ ਥੋੜ੍ਹੁੇ ਥੋੜ੍ਹੇ ਬੀ ਨਿਕਲਣੇ ਸ਼ੁਰੂ ਹੋ ਗਏ ਜਿਹੜੇ ਕਿ ਬਹੁਤ ਵਧੀਆ ਖਪਾਉਣ ਅੱਜ ਕੱਲ੍ਹ ਅਸੀਂ ਸਬਜ਼ੀ ਵਿੱਚ ਵਰਤਦੇ ਹਾਂ ਬਹੁਤ ਵਧੀਆ ਸਜਾਵਟ ਅਤੇ ਬਹੁਤ ਘਰ ਦੀ ਖੇਤੀ ਹੈ ਇਸ ਲਈ ਮੈਨੂੰ ਬਾਗ਼ਬਾਨੀ ਦਾ ਬਹੁਤ ਸ਼ੌਕ ਹੈ ਅਤੇ ਘਰ ਸਭ ਨੂੰ ਕਰਨੀ ਵੀ ਚਾਹੀਦੀ ਹੈ